ਮੈਂ ਦਸ ਦਿਨ ਪਹਿਲਾਂ ਫਲਿੱਪਕਾਰਟ ਤੋਂ ਲੈਕਮੇ ਦਾ ਮੇਕਅਪ ਕਿੱਟ ਔਰਡਰ ਕੀਤਾ ਸੀ ਜੋ ਕਿ ਮੈਂ ਕੱਲ੍ਹ ਰਿਸੀਵ ਕਰ ਲਿਆ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦੀ ਪੈਕੇਜਿੰਗ ਬਹੁਤ ਵਧੀਆ ਹੈ ਅਤੇ ਡਿਲੀਵਰੀ ਵੀ ਸਮੇਂ ਸਿਰ ਹੋਈ ਅਤੇ ਉਸ ਤੋਂ ਬਾਅਦ ਮੈਂ ਪੈਕੇਜਿੰਗ ਓਪਨ ਕੀਤੀ ਅਤੇ ਇਹਦੇ ਵਿੱਚ ਲਿੱਪਸਟਿਕ ਫਾਊਂਡੇਸ਼ਨ ਕੌਮਪੈਕਟ ਆਈ ਲਾਇਨਰ ਨੇਲ ਪੇਂਟ ਮਸਕਾਰਾ ਸੀ ਇਹ ਸਾਰੇ ਪ੍ਰੋਡਕਟ ਬਹੁਤ ਜ਼ਿਆਦਾ ਚੰਗੇ ਸੀ ਅਤੇ ਇਹਨਾਂ ਦਾ ਪ੍ਰਾਈਸ ਮੈਨੂੰ ਮਾਰਕੀਟ ਨਾਲੋਂ ਬਹੁਤ ਘੱਟ ਰੇਟ 'ਤੇ ਮਿਲਿਆ ਜਿਹੜੀ ਇਹ ਮੇਕਅਪ ਕਿੱਟ ਹੈ ਮੇਰੀ ਭੈਣਾਂ ਨੂੰ ਵੀ ਬਹੁਤ ਵਧੀਆ ਲੱਗੀ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅਸ ਸੀ ਜੋ ਮੈਂ ਫਲਿੱਪਕਾਰਟ ਤੋਂ ਮੇਕਅਪ ਕਿਟ ਖਰੀਦੀ ਹੈ ਅਤੇ ਅੱਗੇ ਤੋਂ ਵੀ ਮੈਂ ਸੋਚਿਆ ਹੈ ਕਿ ਮੈਂ ਇਸੇ ਕੰਪਨੀ ਤੋਂ ਸਾਰਾ ਸਮਾਨ ਖਰੀਦਾਂਗੀ ਕੰਪਨੀ ਦਾ ਮੈਨੂੰ ਸਮੇਂ 'ਤੇ ਔਰਡਰ ਦੇਣ ਲਈ ਧੰਨਵਾਦ